ਜੇਕਰ ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਜੋ ਕਿ ਅੱਜ ਕੱਲ੍ਹ ਇੱਕ ਮਹੱਤਵਪੂਰਨ ਵਿਸ਼ਾ ਹੈ ਹਰ ਇੱਕ ਲਈ ਸਿੱਖਿਆ ਨੂੰ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਦਾ ਸਮਾਂ ਹੀ ਏਦਾਂ ਦਾ ਆ ਗਿਆ ਹੈ ਕਿ ਬੰਦੇ ਨੂੰ ਐਜੂਕੇਟਿਡ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ ਪਰ ਕਈ ਖੇਤਰ ਅਜਿਹੇ ਹਨ ਜਿ ਜਿੱਥੇ ਸਿੱਖਿਆ ਵਿਵਸਥਾ ਚੰਗੀ ਨਹੀਂ ਹੈ ਫਿਰ ਅਜਿਹੇ ਖੇਤਰਾਂ ਵਿੱਚ ਲੋਕ ਆਪਣੇ ਉਸ ਖੇਤਰ ਨੂੰ ਛੱਡ ਕੇ ਦੂਜੇ ਖੇਤਰ ਵਿੱਚ ਜਿੱਥੇ ਸਿੱਖਿਆ ਦੀ ਵਿਵਸਥਾ ਠੀਕ ਹੈ ਉੱਥੇ ਜਾਂਦੇ ਹਨ ਜਿਵੇਂ ਕਿ ਚੰਡੀਗੜ੍ਹ ਹੋ ਗਿਆ ਦਿੱਲੀ ਇੱਥੇ ਸਿੱਖਿਆ ਲਈ ਅਜਿਹੇ ਸੈਂਟਰ ਮਿਲ ਜਾਂਦੇ ਹਨ ਜੋ ਕਾਫ਼ੀ ਚੰਗੇ ਹਨ ਅਤੇ ਜਾਇਓ ਕਈ ਲੋਕ ਤਾਂ ਫਿਰ ਕੈਨੇਡਾ ਜਾਂ ਅਮਰੀਕਾ ਜਾ ਕੇ ਵੀ ਸਟੱਡੀ ਕਰਦੇ ਹਨ ਕਿਉਂਕਿ ਉਹ ਬਹੁਤ ਹਾਈ ਲੈਵਲ 'ਤੇ ਸਟੱਡੀ ਕਰਨਾ ਚਾਹੁੰਦੇ ਹਨ ਅਤੇ ਚੰਗੇ ਜੌਬ ਲੈਣਾ ਚਾਹੁੰਦੇ ਹਨ ਜੇਕਰ ਆਪਾਂ ਖੇਤਰ ਦੀ ਗੱਲ ਕਰੀਏ ਤਾਂ ਕੁਝ ਲੋਕ ਆਰਟਸ ਖੇਤਰ ਲੈਂਦੇ ਹਨ ਅਤੇ ਉਹ ਫਿਰ ਉਹ ਜੌਬ ਲੱਭਦੇ ਹਨ ਕੁਝ ਲੋਕ ਕਾਮਰਸ ਖੇਤਰ ਲੈਂਦੇ ਹਨ ਜਿਹੜੇ ਜਿਹੜੇ ਬੈਂਕਿੰਗ ਸੈਕਟਰ ਜਾਂਦੇ ਆ ਜਾਂ ਫਾਇਨਾਸ਼ਲੀ ਕੰਮ ਕਰਨਾ ਚਾਹੁੰਦੇ ਹਨ ਉਹ ਕਮਰਸ ਲੈ ਲੈਂਦੇ ਹਨ ਸਾਇੰਸ ਦੀ ਗੱਲ ਕਰੀਏ ਤਾਂ ਜਿਹੜੇ ਏ ਸਾਇੰਸ ਨਾਲ ਰੀਲੇਟਡ ਹਨ ਜਾਂ ਫਿਰ ਇਸ ਵਿੱਚ ਦਿਲਚਸਪੀ ਰੱਖਦੇ ਹਨ ਸਾਇੰਸ ਵਿੱਚ ਤਾਂ ਉਹ ਸਾਇੰਸ ਲੈ ਲੈ ਲੈ ਲੈਂਦੇ ਹਨ ਨਰਸਿੰਗ ਨਰਸਿੰਗ ਦੀ ਏ ਜੇਕਰ ਗੱਲ ਕਰੀ ਕੀਤੀ ਜਾਵੇ ਤਾਂ ਜੇਕਰ ਕੁਝ ਕੁਝ ਲੋਕਾਂ ਦੀ ਭਾਵਨਾ ਹੁੰਦੀ ਹੈ ਕਿ ਉਹ ਮਰੀਜ਼ਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਤਾਂ ਉਹ ਨਰਸਿੰਗ ਨਰਸਿੰਗ ਲੈ ਲੈਂਦੇ ਹਨ ਕਿਉਂਕਿ ਨਰਸਿੰਗ ਦੀ ਬਾਹਰ ਵੀ ਬਹੁਤ ਡਿਮਾਂਡ ਹੈ ਆਈ ਟੀ ਆਈ ਦੀ ਗੱਲ ਕਰੀ ਜਾਵੇ ਤਾਂ ਕੁਝ ਲੋਕ ਆਈ ਟੀ ਆਈ ਲੈ ਲੈਂਦੇ ਹਨ ਅਤੇ ਉਸ ਵਿੱਚ ਡਿਪਲੋਮਾ ਕਰਦੇ ਹਨ ਆਈ ਟੀ ਆਈ ਵਿੱਚ ਵੀ ਕਈ ਤਰ੍ਹਾਂ ਦੇ ਡਿਪਲੋਮੇ ਹੁੰਦੇ ਹਨ ਜਿਸ ਨੂੰ ਕਰਨ ਤੋਂ ਬਾਅਦ ਇੱਕ ਚੰਗੀ ਨੌਕਰੀ ਵੀ ਮਿਲ ਜਾਂਦੀ ਹੈ ਅਤੇ ਆਈ ਟੀ ਆਈ ਦੇ ਵਿੱਚ ਗੌਰਮਿਟ ਦੀ ਕਈ ਸਕੀਮਾਂ ਹੁੰਦੀਆਂ ਹਨ ਜਿਸ ਨਾਲ ਗਰੀਬ ਬੱਚੇ ਵੀ ਇਹ ਕੋਰਸ ਕਰ ਲੈਂਦੇ ਹਨ ਐਗਰੀਕਲਚਰ ਦੀ ਗੱਲ ਕਰੀ ਜਾਵੇ ਤਾਂ ਐਗਰੀਕਲਚਰ ਲੈਂਦੇ ਕੁਝ ਲੋਕ ਐਗਰੀਕਲਚਰ ਲੈਂਦੇ ਹਨ ਜਿਸ ਨਾਲ ਕਿ ਉਹਨਾਂ ਨੂੰ ਆਪਣੀ ਖੇਤੀ ਕਰਨ ਵਿੱਚ ਵੀ ਬਹੁਤ ਮਦਦ ਹੋ ਜਾਂਦੀ ਹੈ ਉਹਨਾਂ ਨੂੰ ਖੇਤੀ ਦਾ ਵਿਗਿਆਨਕ ਢੰਗ ਪਤਾ ਲੱਗ ਜਾਂਦਾ ਹੈ ਵੀ ਖੇਤੀ ਕਿਸ ਤਰ੍ਹਾਂ ਕਰਨੀ ਹੈ ਅਤੇ ਇੰਜੀਨੀਅਰਿੰਗ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਇੰਜੀਨੀਅਰਿੰਗ ਦਾ ਜ਼ਮਾਨਾ ਹੈ ਤਾਂ ਬਹੁਤ ਸਾਰੇ ਲੋਕ ਇੰਜੀਨੀਅਰਿੰਗ ਕਰਦੇ ਹਨ ਕੁਝ ਲੋਕ ਮੈਡੀਕਲ ਜਾਂ ਮੈਡੀਕਲ ਲੈ ਲੈਂਦੇ ਹਨ ਅਤੇ ਉਹ ਡਕ ਡਾਕਟਰ ਬਣ ਜਾਂਦੇ ਹਨ ਕੁਝ ਲੋਕ ਬੀ ਐੱਡ ਕਰਕੇ ਫਿਰ ਜੋ ਟੀਚਿੰਗ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਬੀ ਐੱਡ ਲਾਇਨ 'ਚ ਚਲੇ ਜਾਂਦੇ ਹਨ ਇਸ ਤਰ੍ਹਾਂ ਸਿੱਖਿਆ ਤਾਂ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ ਅਤੇ ਹਰ ਇੱਕ ਨੂੰ ਸਿੱਖਿਅਤ ਹੋਣਾ ਚਾਹੀਦਾ ਹੈ